ਟਾਟਾ ਨੈਨੋ ਟਾਟਾ ਇੰਡੀਕਾ ਟਾਟਾ ਟਿਆਗੋ ਟਾਟਾ ਪੰਚ ਟਾਟਾ ਨੈਕਸਨ ਟਾਟਾ ਹੈਰੀਅਰ ਟਾਟਾ ਸਫਾਰੀ ਟਾਟਾ ਸੂਮੋ ਟਾਟਾ ਅਲਟ੍ਰੋਸ ਹਿੰਡਾਈ ਸੈਂਟਰੋ ਹੁੰਡਾਈ ਆਈ ਟੈਂਨ ਗਰੈਂਡ ਹੁੰਡਾਈ ਆਈ ਟੈਨ ਮੈਗਨਮ ਹੁੰਡਾਈ ਆਈ ਟਵੈਂਟੀ ਸਪੋਰਟਸ ਹੁੰਡਾਈ ਵਰਨਾ ਹੁੰਡਾਈ ਕਰੇਟਾ ਹੋਂਡਾ ਅਮੇਜ ਹੋਂਡਾ ਐਕਟੀਵਾ ਹੀਰੋ ਹਾਂਡਾ ਮਰੂਤੀ ਸਜੂਕੀ ਮਾਰੂਤੀ ਸਜੂਕੀ ਬਲੇਨੋ ਮਰੂਤੀ ਆਲਟੋ ਵੈਗਆਰ ਮਰੂਤੀ ਸਿਲੈਰੀਓ